ਇੱਕ ਬਾਲਟੀ ਵਿੱਚ ਪਾਣੀ ਲੈ ਕੇ ਉਹਨੂੰ ਸਰਫ ਨੂੰ ਘੋਲ ਲਵੋ ਉਸ ਤੋਂ ਬਾਅਦ ਤੁਹਾਡੇ ਆਪਣੇ ਤੁਸੀਂ ਕੱਪੜੇ ਪਾਉਣੇ ਕੱਪੜੇ ਪਾ ਕੇ ਉਹਨੂੰ ਭਿਓਂ ਦਿਓ ਕਮ ਸੇ ਕਮ ਅੱਧੇ ਘੰਟੇ ਤੋਂ ਲੈ ਕੇ ਘੰਟੇ ਤੱਕ ਭਿਗੋ ਕੇ ਰੱਖੋ ਇਹਦੇ ਨਾਲ ਇਹ ਹੁੰਦਾ ਕਿ ਤੁਹਾਡੇ ਕੱਪੜੇ ਜਿਹੜੇ ਗੰਦੇ ਹੁੰਦੇ ਨੇ ਉਹ ਸਾਫ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਲਟੀ ਵਿੱਚੋਂ ਕੱਢ ਕੇ ਅਤੇ ਕੱਪੜੇ ਉਹਨੂੰ ਧੋ ਲਿਓ ਧੋ ਕੇ ਨਿਚੋੜ ਕੇ ਤੁਸੀਂ ਈਜੀਲੀ ਸੁਕਣੇ ਪਾ ਸਕਦੇ ਹੋ ਅਤੇ ਕਈ ਲੋਕੀ ਇੱਦਾਂ ਹੁੰਦੇ ਕਿ ਮਸ਼ੀਨ ਵਿੱਚ ਵੀ ਕੱਪੜੇ ਧੋਂਦੇ ਨੇ ਮਸ਼ੀਨ ਵਿੱਚ ਵੀ ਇਹੀ ਪ੍ਰੋਸੈਸ ਹੁੰਦਾ ਕਿ ਕੱਪੜੇ ਤੁਸੀਂ ਮਸ਼ੀਨ ਵਿੱਚ ਪਾਣੀ ਪਾ ਕੇ ਅਤੇ ਵਿੱਚ ਸਰਫ ਪਾ ਕੇ ਅਤੇ ਕੱਪੜੇ ਧੋ ਦਿਓ ਉਸ ਤੋਂ ਬਾਅਦ ਉਹ ਨਿਚੋੜ ਕੇ ਅਤੇ ਸੁਕਣੇ ਪਾ ਦਿਓ ਕਈ ਵਾਰੀ ਬਰਸਾਤਾਂ ਦਾ ਮੌਸਮ ਹੁੰਦਾ ਹੈ ਸਰਦੀਆਂ ਦਾ ਮੌਸਮ ਹੁੰਦਾ ਹੈ ਅਤੇ ਕੱਪੜੇ ਜਲਦੀ ਨਹੀਂ ਸੁੱਕਦੇ ਅਤੇ ਕੱਪੜੇ ਸੁਕਾਉਣ ਲਈ ਉਹਨੂੰ ਕੱਪੜਿਆਂ ਨੂੰ ਧੋ ਕੇ ਅਤੇ ਮਸ਼ੀਨ ਵਿੱਚ ਵੀ ਸੁਕਾ ਸਕਦੇ ਹੋ ਮਸ਼ੀਨ ਵਿੱਚ ਇਹ ਫਾਇਦਾ ਹੁੰਦਾ ਕਿ ਪਾਣੀ ਸਾਰਾ ਨੁਚੜ ਜਾਂਦਾ ਅਤੇ ਤੁਸੀਂ ਇਜੀਲੀ ਆਸਾਨੀ ਨਾਲ ਕੱਪੜੇ ਤੁਸੀਂ ਸੁਕਣੇ ਪਾ ਸਕਦੇ ਹੋ ਅਤੇ ਕੱਪੜੇ ਤੁਹਾਨੂੰ ਤੁਹਾਡੇ ਜਲਦੀ ਸੁੱਕ ਸਕਦੇ ਨੇ ਇਸ ਤੋਂ ਬਾਅਦ